ਹਾਂਜੀ ਮੈਂ ਤਰਨ ਤਾਰਨ ਜ਼ਿਲ੍ਹੇ ਦਾ ਵਸਨੀਕ ਹਾਂ ਸਾਡੇ ਸ਼ਹਿਰ ਦੇ ਨੇੜੇ ਵੱਸਦੇ ਪਿੰਡਾਂ ਵਿੱਚ ਵੱਸਦਾ ਭਾਈਚਾਰਾ ਖੇਤੀਬਾੜੀ ਹੈ ਸਾਡੇ ਇਲਾਕੇ ਦੇ ਲੋਕ ਮੁੱਖ ਤੌਰ 'ਤੇ ਕਣਕ ਝੋਨਾ ਅਤੇ ਹਰੀਆਂ ਸਬਜ਼ੀਆਂ ਆਲੂ ਦੀ ਕਾਸ਼ਤ ਕਰਦੇ ਹਨ ਫਸਲਾਂ ਤੋਂ ਇਲਾਵਾ ਹਰੀਆਂ ਸਬਜ਼ੀਆਂ ਜਿਵੇਂ ਸਰੋਂ ਦਾ ਸਾਗ ਗੋਭੀ ਪੱਤਾ ਗੋਭੀ ਗਾਜਰ ਆਲੂ ਟਮਾਟਰ ਬੈਂਗਣ ਟੀਂਡੇ ਘੀਆ ਤੋਰੀ ਆਦਿ ਵਰਗੀਆਂ ਸਬਜ਼ੀਆਂ ਦਾ ਵੀ ਉਤਪਾਦਨ ਕਰਦੇ ਹਾਂ ਫਸਲਾਂ ਦੀ ਸਿੰਚਾਈ ਲਈ ਟਿਊਬਲ ਦੀ ਵਰਤੋਂ ਕਰਦੇ ਹਨ ਅਤੇ ਖੇਤੀਬਾੜੀ ਲਈ ਟਰੈਕਟਰਾਂ ਕੰਬਾਈਨਾਂ ਥਰੈਸ਼ਰਾਂ ਵਰਗੀ ਟੈਕਨੋਲਜੀ ਦੀ ਵਰਤੋਂ ਕਰਦੇ ਹਨ ਅਤੇ ਚੰਗੀਆਂ ਖੇਤੀਬਾੜੀ ਤਕਨੀਕਾਂ ਅਤੇ ਖੇਤੀਬਾੜੀ ਮਾਹਰਾਂ ਦੀ ਸਲਾਹ ਨਾਲ ਵੱਧ ਤੋਂ ਵੱਧ ਫਸਲਾਂ ਨਾਲ ਯੋਗਦਾਨ ਪਾਉਂਦੇ ਹਨ ਜਿਸ ਨਾਲ ਇਲਾਕੇ ਦੇ ਵਿੱਚ ਅਮਨ ਆਮ ਜਨਤਾ ਨੂੰ ਅਨਾਜ ਸਬਜ਼ੀਆਂ ਆਸਾਨੀ ਨਾਲ ਉਪਲੱਬਧ ਹੋ ਜਾਂਦਾ ਹੈ ਅਤੇ ਇਸ ਨਾਲ ਸ਼ਹਿਰ ਦੀ ਅਰਥ ਵਿਵਸਥਾ ਵੀ ਠੀਕ ਬਣੀ ਰਹਿੰਦੀ ਹੈ